ਹੈਲੋ ਹੈਲੋ ਰਣਜੀਤ ਕਿਆ ਹਾਲ ਹੈ ਬਸ ਵਧੀਆ ਵਧੀਆ ਤੂੰ ਸੁਣਾ ਕੀ ਕਰੀ ਜਾਂਦੇ ਸੀ ਕਾਰੋਬਾਰ ਵਧੀਆ ਹਮ ਅੱਛਾ ਕੰਮ ਕੁੰਮ ਦੇਖਿਆ ਕੋਈ ਕਿਵੇਂ ਦਾ ਬਿਜਨਸ ਹਾਂ ਹਮ ਮੈਂ ਸੋਚਦੀ ਸੀ ਜਿਵੇਂ ਮੈਨੂੰ ਸਟੀਚਿੰਗ ਆਉਂਦੀ ਹੈ ਹੈ ਨਾ ਤਾਂ ਆਪਾਂ ਬੁਟੀਕ ਦਾ ਕੰਮ ਵੀ ਦੇਖ ਸਕਦੇ ਹਾਂ ਹੈ ਨਾ ਹਾਂ ਵੀ ਆਪਾਂ ਦੋਨੋਂ ਕਰਕੇ ਮਿਲ ਕੇ ਕਰ ਲਈਏ ਕਿਉਂਕਿ ਮੈਨੂੰ ਸਟੀਚਿੰਗ ਆਉਂਦੀ ਹੈ ਹੈ ਨਾ ਅਤੇ ਉਹਦੇ ਨਾਲ ਥੋੜ੍ਹਾ ਠੀਕ ਪੈ ਸਕਦਾ

ਹਾਂਜੀ

ਕਿਉਂਕਿ ਐਵੇਂ ਹੈ ਨਾ ਇਸ ਤੋਂ ਅੱਗੇ ਆਪਾਂ ਇਹਨੂੰ ਰੈਡੀਮੇਡ 'ਚ ਵੀ ਕਨਵਰਟ ਕਰ ਸਕਦੇ ਹਾਂ ਨਾ ਵੀ ਬਣਾ ਕੇ ਰੈਡੀਮੇਡ ਵੇਚ ਨਾ ਮਤਲਬ ਅੱਗੇ ਤੋਂ ਅੱਗੇ ਕਾਫੀ ਨਿਕਲਿਆ ਜਿੰਨੇ ਬੁਟੀਕ 'ਚੋਂ ਅੱਗੇ ਦੀ ਅੱਗੇ ਕਾਫੀ ਕੰਮ ਹੋ ਜਾਂਦਾ ਹਾਂ ਫਿਰ ਆਪਾਂ ਕਿਸੇ ਦਿਨ ਜਾਂ ਤਾਂ ਬੈਠ ਕੇ ਮਿਲ ਕੇ ਡਿਸਕਸ ਕਰਦੇ ਹਾਂ ਤੁਸੀਂ ਆਈਓ ਮੇਰੇ ਘਰ ਫਿਰ ਸੰਡੇ ਨੂੰ ਬੈਠ ਕੇ ਨਾ ਹਾਂ ਆਰਾਮ ਨਾਲ

ਹਾਂ ਐਂ ਕਰਦੇ ਹਾਂ ਆਰਾਮ ਨਾਲ ਬੈਠ ਕੇ ਮਿਲਦੇ ਠੀਕ ਹੈ ਜੀ ਓਕੇ